ਮੈਂ ਆਪਣੇ ਦੋਸਤ ਜਾਂ ਆਪਣੇ ਪਰਿਵਾਰ ਨਾਲ ਪਿਕਨਿਕ ਮਨਾਉਣ ਆਮ ਤੌਰ 'ਤੇ ਪਾਰਕ ਦੇ ਵਿੱਚ ਜਾਂਦੀ ਹਾਂ ਜਿਹੜਾ ਸਾਡੇ ਘਰ ਦੇ ਨੇੜੇ ਬਹੁਤ ਹੀ ਵਧੀਆ ਬਣਿਆ ਹੋਇਆ ਉੱਥੇ ਹਰ ਤਰੀਕੇ ਦੇ ਝੂਲੇ ਹਨ ਮੈਂ ਆਪਣੇ ਜਵਾਕ ਨੂੰ ਝੂਲੇ ਦਵਾ ਕੇ ਉਹਦਾ ਇੰਟਰਟੇਨਮੈਂਟ ਕਰਕੇ ਅਤੇ ਉਸਨੂੰ ਖੁਸ਼ ਕਰਨ ਦੀ ਕੋਸ਼ਿਸ਼ ਕਰਦੀ ਹਾਂ ਕਿਉਂਕਿ ਧੀ ਦੀ ਖੁਸ਼ੀ ਦੇ ਵਿੱਚ ਹੀ ਮਾਂ ਦੀ ਖੁਸ਼ੀ ਹੈ ਅਤੇ ਖਾਲੀ ਸਮੇਂ ਦੇ ਵਿੱਚ ਮੈਂ ਉਹਨੂੰ ਝੂਲੇ ਝਲਾਉਂਦੀ ਹਾਂ ਫਿਰ ਉਸ ਤੋਂ ਬਾਅਦ ਅਸੀਂ ਘਾਹ ਦੇ ਵਿੱਚ ਬੈਠ ਕੇ ਖਾਣਾ ਪੀਣਾ ਕਰ ਲੈਂਦੇ ਹਾਂ ਕਦੇ ਗਰਮੀਆਂ ਦੇ ਵਿੱਚ ਅਸੀਂ ਜ਼ਿਆਦਾਤਰ ਆਈਸਕ੍ਰੀਮ ਖਾਂਦੇ ਹਾਂ ਅਤੇ ਉਸ ਤੋਂ ਬਾਅਦ ਜਿਹੜਾ ਕਿ ਹੈਗਾ ਅਸੀਂ ਜਿਹਨਾਂ ਨਾਲ ਵੀ ਘਰ ਪਰਿਵਾਰ ਦਿਆਂ ਨਾਲ ਜਾਂ ਦੋਸਤਾਂ ਨਾਲ ਜਿਹਨਾਂ ਨਾਲ ਵੀ ਅਸੀਂ ਜਾਂਦੇ ਹਾਂ ਫਿਰ ਉੱਥੇ ਬੈਠ ਕੇ ਅਸੀਂ ਗੀਤ ਸੰਗੀਤ ਦੀ ਇੱਕ ਮਹਿਫਲ ਲਾ ਲੈਂਦੇ ਹਾਂ ਜਾਂ ਹੋਰ ਤਰੀਕੇ ਦੀਆਂ ਗੇਮਸ ਖੇਡ ਲੈਂਦੇ ਹਾਂ ਵੱਡੇ ਇੱਕ ਅਲੱਗ ਤਰੀਕੇ ਦੀ ਗੇਮਸ ਦੇ ਵਿੱਚ ਇਨਵੋਲਵ ਹੋ ਜਾਂਦੇ ਹਨ ਜਾਂ ਸ਼ਾਮਿਲ ਹੋ ਜਾਂਦੇ ਹਨ ਅਤੇ ਜਵਾਕ ਆਪ ਦੇ ਜਵਾਕਾਂ ਦੇ ਨਾਲ ਖੇਡਾਂ ਦੇ ਵਿੱਚ ਲੱਗਿਆ ਰਹਿੰਦਾ